ਹੈਲੋ ਹਾਂਜੀ ਮੈਂ ਅ ਤੁਹਾਡੇ ਨਾਲ ਅੱਜ ਆਪਣੇ ਔਨਲਾਈਨ ਖਰੀਦੇ ਹੋਏ ਸ਼ੂ ਦਾ ਮੈਂ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੇ ਨਾਇਕੀ ਦੀ ਕੰਪਨੀ ਤੋਂ ਸ਼ੂ ਲਿਆ ਸੀ ਬਟ ਇਸ ਦੀ ਕੁਆਲਿਟੀ ਬਹੁਤ ਅੱਛੀ ਸੀ ਇਹਦਾ ਸੋਲ ਬਹੁਤ ਅੱਛਾ ਸੀ ਮੈਨੂੰ ਵੋਕ ਕਰਦੇ ਹੋਏ ਸ਼ੂ ਦੀ ਬਹੁਤ ਲੋੜ ਸੀ ਕਿਉਂਕਿ ਮੈਨੂੰ ਲੱਗਿਆ ਇਹਦਾ ਸੋਲ ਬਹੁਤ ਅੱਛਾ ਹੈ ਇਹ ਇੰਨਾ ਕੰਫਰਟੇਬਲ ਹੈ ਉਹ ਰੀਜਨੇਬਲ ਪ੍ਰਾਈਜ਼ 'ਤੇ ਮਿਲਿਆ ਅਤੇ ਮੈਂ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕੀਤਾ ਕਿ ਏਡੀਡਾਸ ਕੰਪਨੀ ਤੋਂ ਸ਼ੂ ਮੰਗਵਾਓ ਬਹੁਤ ਕੁਆਲਿਟੀ ਅੱਛੀ ਹੈ ਬਹੁਤ ਪੈਕਿੰਗ ਅੱਛੀ ਹੈ ਰੀਜਨੇਬਲ ਪ੍ਰਾਈਜ਼ ਹੈ ਉਸ ਤੋਂ ਬਾਅਦ ਮੈਂ ਆਪਣੀ ਸਿਸਟਰ ਨੂੰ ਬ੍ਰਦਰ ਨੂੰ ਸਾਰਿਆਂ ਨੂੰ ਹੀ ਇਹ ਕੰਪਨੀ ਦਾ ਸ਼ੂ ਲੈ ਕੇ ਦਿੱਤਾ ਤਾਂ ਜੋ ਮੈਨੂੰ ਐਵੇਂ ਲੱਗਦਾ ਸੀ ਕਿ ਇਹਦੀ ਸੇਲ ਵੱਧ ਤੋਂ ਵੱਧ ਹੋਵੇ ਕਿਉਂਕਿ ਇਹ ਸ਼ੂ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਕੰਫਰਟੇਬਲ ਲੱਗਿਆ ਥੈਂਕ ਯੂ